ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦੇ ਟਾਈਮ ਅਤੇ ਹੁਣ ਦੇ ਟਾਈਮ 'ਚ ਬਹੁਤ ਅੰਤਰ ਆਇਆ ਹੈ ਫਰਕ ਆਇਆ ਹੈ ਪਹਿਲਾਂ ਦੇ ਜ਼ਮਾਨੇ ਵਿੱਚ ਲੋਕਾਂ ਦੇ ਘਰਾਂ ਵਿੱਚ ਟੀ ਵੀ ਨਹੀਂ ਹੁੰਦੇ ਸੀ ਕਿਸੇ ਦੇ ਹੱਥ ਵਿੱਚ ਮੋਬਾਇਲ ਨਹੀਂ ਹੁੰਦਾ ਸੀਗਾ ਅਤੇ ਲੋਕ ਮਨੋਰੰਜਨ ਕਰਦੇ ਸੀਗੇ ਨਾਟਕ ਕਰਦੇ ਸੀਗੇ ਚਿੱਤਰਹਾਰ ਵਗੈਰਾ ਕਰਦੇ ਸੀਗੇ ਆਪਸ ਘਰਾਂ 'ਚ ਫਿਰ ਹੌਲੀ ਹੌਲੀ ਟੀ ਵੀ ਆਇਆ ਟੀ ਵੀ ਤੋਂ ਲੋਕ ਟੀ ਵੀ ਵੇਖਣ ਲੱਗ ਪਏ ਕਦੀ ਕਿਤੇ ਕਿਸੇ ਦੇ ਘਰ 'ਚ ਇੱਕ ਘਰ 'ਚ ਪੰਜਾਹ ਪੰਜਾਹ ਬੰਦੇ ਮੁਹੱਲੇ 'ਚ ਜਾ ਕੇ ਘਰ 'ਚ ਜਾ ਕੇ ਟੀ ਵੀ ਦੇਖਦੇ ਸੀਗੇ ਫਿਰ ਹੁਣ ਦੇ ਟਾਈਮ 'ਚ ਇਹ ਅੰਤਰ ਆ ਕਿ ਹੁਣ ਦੇ ਟਾਈਮ 'ਚ ਕਾਫੀ ਲੋਕਾਂ ਕੋਲ ਮਤਲਬ ਲਗਭਗ ਹਰ ਕਿਸੇ ਕੋਲ ਮੋਬਾਈਲ ਫੋਨ ਆ ਹੱਥ 'ਚ ਔਨਲਾਈਨ ਸਭ ਕੁਝ ਵੇਖਦਾ ਹਰ ਇੰਡੀਆ ਦੀਆਂ ਭਾਰਤ ਦੀਆਂ ਬਾਹਰ ਦੀਆਂ ਖਬਰਾਂ ਸਾਰੀਆਂ ਖਬਰਾਂ ਫੋਨ 'ਤੇ ਵੇਖ ਲੈਂਦਾ ਕੋਈ ਵੀ ਹਾਸੇ ਦਾ ਕੋਈ ਵੀ ਸੁੱਖ ਦੁੱਖ ਦਾ ਕੋਈ ਵੀ ਕਿਸੇ ਨਾਲ ਗੱਲ ਕਰਨੀ ਹੈ ਵੀਡੀਓ ਕੋਲ 'ਤੇ ਕੋਈ ਸੰਪਰਕ ਕਰਨਾ ਪਹਿਲਾਂ ਦੇ ਟਾਈਮ 'ਚ ਚਿੱਠੀਆਂ ਭੇਜਣੀਆਂ ਪੰਦਰਾਂ ਪੰਦਰਾਂ ਵੀਹ ਵੀਹ ਦਿਨ ਮਹੀਨਾ ਮਹੀਨਾ ਚਿੱਠੀਆਂ ਪੁੱਜਣ ਨੂੰ ਲੱਗ ਜਾਂਦਾ ਸੀਗਾ ਵਿਦੇਸ਼ਾਂ ਵਿੱਚ ਵੀ ਅੱਜ ਕੱਲ੍ਹ ਇੱਕ ਸੈਕਿੰਡ ਦੇ ਵਿੱਚ ਇੱਕ ਦੂਜੇ ਨਾਲ ਵੀਡੀਓ ਕੋਲ 'ਤੇ ਹਾਲ ਚਾਲ ਪਤਾ ਲੱਗ ਜਾਂਦਾ ਕੌਣ ਕੀ ਕਰ ਰਿਹਾ ਕਿੱਥੇ ਜਾ ਰਿਹਾ ਕਾਫੀ ਜ਼ਿਆਦਾ ਫਰਕ ਪਿਆ ਪਹਿਲਾਂ ਨਾਲੋਂ ਅਤੇ ਹੁਣ ਨਾਲੋਂ ਇੰਡ ਭਾਰਤ ਵੀ ਕਾਫੀ ਜ਼ਿਆਦਾ ਅੱਗੇ ਵੱਧ ਰਿਹਾ ਭਾਰਤ ਨੇ ਕਾਫੀ ਖੋਜਾਂ ਕੀਤੀਆਂ ਆਪਣੇ ਦੇਸ਼ ਨੂੰ ਉਜਾਗਰ ਕਰਨ ਲਈ ਧਰਤੀ 'ਤੇ ਜਿੰਨੇ ਵੀ ਦੇਸ਼ ਨੇ ਉਹਨਾਂ 'ਤੇ ਲਗਭਗ ਜ਼ਿਆਦਾਤਰ ਭਾਰਤ ਉੱਚੇ ਸਥਾਨ 'ਤੇ ਹੈਗਾ ਵਾ